ਹੈਲੋ ਨਮਸਕਾਰ ਭਾਈ ਸਾਹਿਬ ਭਾਈ ਸਾਹਿਬ ਤੁਸੀਂ ਓ ਫੋਟੋ ਵਾਲੀ ਦੁਕਾਨ ਤੋਂ ਫੋਟੋਗ੍ਰਾਫਰ ਬੋਲ ਰਹੇ ਹੋ ਨਾ ਹਾਂਜੀ ਅਤੇ ਭਾਈ ਸਾਹਿਬ ਮੈਂ ਸਰਵਹਿਤਕਰੀ ਸਕੂਲ ਤੋਂ ਬੋਲਦੀ ਹਾਂ ਅਤੇ ਆਪਣੇ ਸਕੂਲ ਨਾ ਫੰਕਸ਼ਨ ਹੋਇਆ ਸੀ ਪਿਛਲੇ ਮਹੀਨੇ ਅਤੇ ਫੰਕਸ਼ਨ ਨੂੰ ਮਹੀਨਾ ਹੋ ਗਿਆ ਉਸ ਤੋਂ ਬਾਅਦ ਅਸੀਂ ਦੋ ਫੰਕਸ਼ਨ ਕਰ ਚੁੱਕੇ ਹਾਂ ਪਰ ਤੁਸੀਂ ਕੋਈ ਫੋਟੋ ਨਹੀਂ ਬਣਾ ਕੇ ਦਿੱਤੀਆਂ ਹਜੇ ਤੱਕ ਨਾ ਬੱਚਿਆਂ ਦੀਆਂ

ਨਹੀਂ ਭਾਈ ਸਾਹਿਬ ਤੁਸੀਂ ਨਾ ਉਹਨਾਂ ਦੇ ਚਾਰਟ ਬਣਾ ਕੇ ਭੇਜੇ ਸੀ ਜਿਹਦੇ 'ਤੇ ਛੋਟੇ ਛੋਟੀਆਂ ਫੋਟੋ ਸੀਗੀਆਂ ਤਾਂ ਆਪਣੀ ਇਹ ਗੱਲ ਹੋਈ ਸੀ ਕਿ ਫੋਟੋ ਬਹੁਤ ਛੋਟੀ ਹੈ ਅਤੇ ਉਹਦੇ 'ਤੇ ਪਰੋਪਰ ਬੱਚੇ ਦਾ ਫੇਸ ਨਹੀਂ ਸਮਝ ਆ ਰਿਹਾ ਅਤੇ ਤੁਹਾਨੂੰ ਇਹ ਕਿਹਾ ਸੀ ਤੁਸੀਂ ਜਾਂ ਤਾਂ ਲੈਪਟੋਪ ਲੈ ਕੇ ਆਓ ਜਾਂ ਤੁਸੀਂ ਮਤਲਬ ਸਾਨੂੰ ਆਪਣੀ ਸ਼ੋਪ ਦਾ ਦੱਸ ਦੋ ਅਸੀਂ ਜਿਸ ਦਿਨ ਤੁਸੀਂ ਫਰੀ ਹੁੰਦੇ ਹੋ ਤਾਂ ਉੱਥੇ ਆ ਕੇ ਤੁਹਾਨੂੰ ਆਰਡਰ ਦੇ ਦਿੰਦੇ ਹਾਂ ਪਰ ਤੁਸੀਂ ਧਿਆਨ ਹੀ ਨਹੀਂ ਦਿੱਤਾ ਨਹੀਂ ਨਹੀਂ ਭਾਈ ਸਾਹਿਬ ਪਤਾ ਕੀ ਆ ਜਦੋਂ ਤੱਕ ਤੁਸੀਂ ਸਾਨੂੰ ਸਾਡੀ ਫੋਟੋ ਨਹੀਂ ਦਿਖਾਓਗੇ ਕਿਉਂਕਿ ਫੋਟੋ ਬਹੁਤ ਜ਼ਿਆਦਾ ਹੁੰਦੀਆਂ ਨੇ ਆਪਾਂ ਇੱਕ ਬੱਚਾ ਕੋਈ ਚਾਰ ਪੰਜ ਪੰਜ ਫੋਟੋ ਤਾਂ ਲੈਂਦੇ ਨਹੀਂ ਨਾ ਅਤੇ ਕੋਈ ਇੱਕ ਲਵੇਗਾ ਕੋਈ ਦੋ ਲਵੇਗਾ ਤਾਂ ਜਿਹੜੀ ਫੋਟੋ ਜ਼ਿਆਦਾ ਸੋਹਣੀ ਹੋਏਗੀ ਆਪਾਂ ਤੁਹਾਨੂੰ ਉਹਦਾ ਆਰਡਰ ਦੇਵਾਂਗੇ ਨਾ ਫਿਰ ਅਤੇ ਕੁਛ ਅਸੀਂ ਆਰਡਰ ਤੁਹਾਨੂੰ ਦਿੱਤੇ ਵੀ ਹੋਏ ਨੇ ਤੁਸੀਂ ਭੁੱਲ ਗਏ ਪਿਛਲੇ ਪੰਦਰ੍ਹਾਂ ਦਿਨ ਪਹਿਲਾਂ ਤੁਸੀਂ ਆਏ ਸੀ ਆਪਣੇ ਸਕੂਲ ਅਤੇ ਜਿਹੜੀ ਗਰੁੱਪ ਫੋਟੋ ਸਾਨੂੰ ਸੋਹਣੀਆਂ ਲੱਗੀਆਂ ਸੀ ਅਸੀਂ ਤੁਹਾਨੂੰ ਆਰਡਰ ਵੀ ਦਿੱਤਾ ਸੀਗਾ ਬਟ ਪਰ ਤੁਸੀਂ ਉਹਦਾ ਵੀ ਕੋਈ ਰਿਸਪਾਂਸ ਨਹੀਂ ਦਿੱਤਾ ਆਪਣੇ ਆਪ ਦੱਸਿਆ ਹੀ ਨਹੀਂ ਆ ਅਤੇ ਨਾ ਫੋਟੋ ਬਣਾ ਕੇ ਦਿੱਤੀਆਂ ਤੁਸੀਂ ਅਤੇ ਹੁਣ ਜਿਹੜੀਆਂ ਸਿੰਗਲ ਸਿੰਗਲ ਬੱਚੇ ਦੀ ਫੋਟੋ ਸੀ ਉਹ ਤੁਹਾਨੂੰ ਕਿਹਾ ਸੀ ਛੋਟੀਆਂ ਨੇ ਸਾਨੂੰ ਸਮਝ ਨਹੀਂ ਆ ਰਹੀ ਤਾਂ ਤੁਸੀਂ ਲੈਪਟੋਪ 'ਤੇ ਦਿਖਾ ਦਓ ਤਾਂ ਜਦੋਂ ਤੁਸੀਂ ਤੁਹਾਡੇ ਦੁਕਾਨ ਦਾ ਕੋਈ ਲੜਕਾ ਆ ਕੇ ਸਾਨੂੰ ਆਪਣੇ ਲੈਪਟੋਪ 'ਤੇ ਫੋਟੋਆਂ ਦਿਖਾ ਦਵੇ ਤਾਂ ਅਸੀਂ ਸਲੈਕਟ ਕਰ ਲਾਵਾਂਗੇ ਅਤੇ ਫਿਰ ਨਹੀਂ ਭਾਈ ਸਾਹਿਬ ਤੁਸੀਂ ਕਹਿ ਦਿੰਦੇ ਹੋ ਮੈਂ ਦੋ ਚਾਰ ਦਿਨ ਪਹਿਲਾਂ ਵੀ ਫੋਨ ਕੀਤਾ ਸੀ ਪਰ ਪੇਰੈਂਟਸ ਸਾਨੂੰ ਉਲਾਂਭਾ ਦਿੰਦੇ ਨੇ ਕਿ ਦੋ ਫੰਕਸ਼ਨ ਹੋ ਗਏ ਲੇਕਿਨ ਤੁਸੀਂ ਸਾਡੀਆਂ ਫੋਟੋ ਨਹੀਂ ਬਣਾਈਆਂ ਇੱਕ ਦੋ ਅਸੀਂ ਕਲਾਜ਼ ਵੀ ਬੋਲੇ ਸੀਗੇ ਗਰੁੱਪ ਫੋਟੋ ਜਿਵੇਂ ਸਫਾਟ ਦੀ ਫੋਟੋ ਸੀਗੀ ਉਹ ਵੀ ਬਣਾਉਣਾ ਆਪਾਂ ਇੱਕ ਵੱਡਾ ਪੋਸਟਰ ਵੀ ਬਣਾਉਣਾ ਸਕੂਲ ਗਰੁੱਪ ਬੱਚਿਆਂ ਦਾ ਅਤੇ ਤੁਸੀਂ ਮੇਰੀ ਹੁਣ ਡਿਮਾਂ ਲਿਖ ਲਓ ਬਈ ਮਤਲਬ ਇੱਕ ਆਪਾਂ ਪੋਸਟਰ ਵੀ ਤਿਆਰ ਕਰਨਾ ਹੈ ਅਤੇ ਇੱਕ ਆਪਾਂ ਕਲੋਜ ਵੀ ਇਕੱਲਾ ਵੀ ਬਣਾਉਣਾ ਹੈ ਜਿਵੇਂ ਤੁਸੀਂ ਸਟਾਫ ਦੀ ਫੋਟੋ ਹੈ ਤਾਂ ਅਸੀਂ ਵਧੀਆ ਵਧੀਆ ਫੋਟੋ ਵੀ ਕਢਵਾਉਣੀ ਜਿਹੜੀ ਅਸੀਂ ਸਿਲੇਬਸ 'ਤੇ ਲਗਵਾਉਣੀਆਂ ਨੇ ਠੀਕ ਹੈ ਭਾਈ ਸਾਹਿਬ

ਚਲ ਭਾਈ ਸਾਹਿਬ ਮੈਨੂੰ ਦੁਬਾਰਾ ਨਾ ਕਹਿਣਾ ਪਵੇ ਦੁਬਾਰਾ ਸ਼ਿਕਾਇਤ ਦਾ ਮੌਕਾ ਨਾ ਦੇਣਾ ਪਏ ਤੁਹਾਨੂੰ ਹਾਂ ਹਾਂਜੀ ਹਾਂਜੀ ਹਾਂਜੀ ਭਾਈ ਸਾਹਿਬ ਠੀਕ ਹੈ ਬਾਈ ਸਾਹਿਬ ਜੀ ਠੀਕ ਹੈ ਓਕੇ